ਜਦੋਂ ਭਾਰਤ ਵਿੱਚ ਮੀਡੀਆ ਪਹਿਲੀ ਵਾਰ ਆਇਆ ਅਤੇ ਦੂਰਦਰਸ਼ਨ ਵਰਗੇ ਚੈਨਲ ਵੀ ਆਏ ਉੱਥੇ ਖ਼ਬਰਾਂ ਚੱਲਦੀਆਂ ਅਤੇ ਮਨੋਰੰਜਨ ਅਤੇ ਸਾਰੇ ਹੀ ਜਿਹੜੇ ਨਿਤ ਪ੍ਰਤੀ ਦਿਨ ਦੇ ਜਿਹੜੇ ਮੀਡੀਆ ਦੇ ਕੰਮ ਸੀ ਉਹ ਇੱਕ ਹੀ ਚੈਨਲ ਕਰਦਾ ਸੀ ਉਹਦੇ ਮਗਰੋਂ ਪ੍ਰਾਈਵੇਟਾਈਜੇਸ਼ਨ ਦਾ ਦੌਰ ਆਇਆ ਉੱਨੀ ਸੌ ਇਕਾਨਵੇਂ ਵਿੱਚ ਨਵੇਂ ਨਵੇਂ ਮੀਡੀਆ ਹਾਊਸਿਸ ਆਏ ਚੈਨਲ ਆਏ ਅਤੇ ਆਪਾਂ ਜੇ ਅਪ ਬੜੀ ਤਬਦੀਲੀ ਦੇਖੀਏ ਉਸ ਟਾਈਮ ਤੋਂ ਲੈ ਕੇ ਇਸ ਟੈਮ ਤੱਕ ਤਾਂ ਇਹ ਹੈ ਵੀ ਜਿਹੜੀ ਮੀਡੀਆ ਦੀ ਐਥੀਕਲ ਸਟੈਂਡਰਡਸ ਹੈ ਜਿਹੜੀ ਉਹਨਾਂ ਦੀ ਮੌਲਕ ਅਤੇ ਨੈਤਿਕ ਜਿਹੜੀ ਜ਼ਿੰਮੇਦਾਰੀਆਂ ਹੈ ਉਹ ਕਿਤੇ ਘੱਟਦੀਆਂ ਨਜ਼ਰ ਆਉਂਦੀਆਂ ਹੈ ਟੀ ਆਰ ਪੀ ਦੇ ਸਦਕਾ ਉਹ ਟੀ ਆਰ ਪੀ ਕੇ ਦੇ ਚੱਲਦਿਆਂ ਉਹ ਕੁਛ ਵੀ ਦਿਖਾਉਂਦੇ ਹੈ ਜਿਵੇਂ ਰੇਹਾ ਚੱਕਰਵਰਤੀ ਦਾ ਕੇਸ ਸੀਗਾ ਇਸ ਸੱਚ ਆਪਾਂ ਕੋਈ ਵੀ ਲੈ ਸਕਦਾ ਨੋਨਸੈਂਸ ਅਤੇ ਜਿਹੜੀ ਦੇਸ਼ ਨੂੰ ਕੋਈ ਵੀ ਕਿਸੇ ਵੀ ਪੱਧਰ 'ਤੇ ਜਿਹੜੀ ਖ਼ਬਰਾਂ ਇੰਪੈਕਟ ਨਹੀਂ ਕਰਦੀਆਂ ਜਿਹੜੇ ਆਮ ਜਨ ਮਾਨਸ ਦੀ ਆਮ ਜਿਹੜੇ ਬੰਦੇ ਦੇ ਜੀਵਨ ਨੂੰ ਕਿੱਥੇ ਵੀ ਅ ਪੋਜੀਟਿਵਲੀ ਇਮਪੈਕਟ ਨਹੀਂ ਕਰਦੀਆਂ ਇਹੋ ਜਿਹੀ ਖ਼ਬਰਾਂ ਚੱਲਣ ਲੱਗੀਆਂ ਜੇ ਆਪਾਂ ਵੱਡੇ ਮੀਡੀਆ ਹਾਊਸਸ ਦਾ ਗੱਲ ਗੱਲ ਕਰੀਏ ਤਾਂ ਜੀਮ ਜੀਅ ਨਿਊਜ਼ ਨੈਟਵਰਕ ਹੈ ਜੀਅ ਨੈਟਵਰਕ ਹੈ ਐਸ ਸੱਚ ਪੂਰਾ ਵੱਡਾ ਹੈ ਐਨ ਡੀ ਟੀ ਵੀ ਇੰਡੀਆ ਹੈ ਅਤੇ ਔਰ ਬ ਜਿਵੇਂ ਆਜ ਤੱਕ ਹੈ ਅਤੇ ਏ ਬੀ ਪੀ ਨਿਊਜ਼ ਨੈਟਵਰਕ ਹੈ ਇਹ ਕੁਛ ਵੱਡੀ ਮੀਡੀਆ ਜਿਹੜੇ ਡਿਜ਼ਟਲ ਮੀਡੀਆ ਨੈਟਵਰਕ ਹੈ ਅਤੇ ਟਾਈਮਸ ਨਾਓ ਵਰਗੇ ਵੀ ਹੁਣ ਬੜੇ ਵੱਡੇ ਪੱਧਰ 'ਤੇ ਸ਼ੁਰੂ ਹੋਣ ਲੱਗੇ ਹੈ ਅਖ਼ਬਾਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਦੈਨਿਕ ਬਾਸਕਰ ਦੈਨਿਕ ਜਾਗਰਣ ਦੇ ਹਿੰਦੀ ਵਿੱਚ ਵੇਖੀਏ ਤਾਂ ਪੰਜਾਬੀ ਵਿੱਚ ਵੀ ਕਈ ਇਹੋ ਜਿਹੇ ਸੰਸਕਰਣ ਹੈ ਅਤੇ ਵੱਡੇ ਅੰਗਰੇਜ਼ੀ ਅਖ਼ਬਾਰ ਜਿਨ੍ਹਾਂ ਦਾ ਸ਼ੁਰੂ ਤੋਂ ਦਬਦਬਾ ਰਿਹਾ ਜਿਵੇਂ ਦਾ ਹਿੰਦੂ ਇੰਡੀਅਨ ਐਕਸਪ੍ਰੈਸ ਗਲੋਬ ਗਲੋਬਲ ਟਾਈਮ ਸੋ ਦਾ ਹਿੰਦੁਸਤਾਨ ਟਾਈਮਸ ਕੋਨਵਿਕ ਟਾਈਮਸ ਇਹੋ ਜਿਹੇ ਅਖ਼ਬਾਰ ਰਹੇ ਹੈ ਤੱਥ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਏ ਐਨ ਆਈ ਅਤੇ ਜਿਹੜੇ ਪੀ ਆਈ ਬੀ ਇੰਡੀਆ ਹੈ ਉਹੀ ਸਾਰੀਆਂ ਖ਼ਬਰਾਂ ਪਹਿਲਾਂ ਪੇਸ਼ ਕਰਦੇ ਨੇ ਚਾਹੇ ਪਾਰਲੇਮੈਂਟ ਦੀ ਪ੍ਰੋਸੀਡਿੰਗ ਹੋਵੇ ਜਾਂ ਕੁਛ ਹੋਰ ਅਤੇ ਉਹਦੇ ਮਗਰੋਂ ਉੱਥੋਂ ਤੱਥ ਲੈ ਕੇ ਸਾਰੇ ਅਖ਼ਬਾਰ ਉੱਧਰੋਂ ਹੀ ਲਿਖਦੇ ਹੈ ਅਤੇ ਸਾਰੇ ਮੀਡੀਆ ਚੱਲ ਵੀ ਉੱਥੋਂ ਹੀ ਤੱਥ ਲੈਂਦੇ ਹੈ ਅਤੇ ਸਾਰੀ ਜਾਣਕਾਰੀਆਂ ਲੈਂਦੇ ਪਰ ਇੱਕ ਸਰਕਾਰ ਦੇ ਪ੍ਰਤੀ ਇੱਕ ਝੁਕਾਅ ਨਜ਼ਰ ਆਉਂਦਾ ਹੈ ਹੁਣ ਸਪੈਸ਼ਲੀ ਅਤੇ ਕਈ ਸਰਕਾਰਾਂ ਦਾ ਜਿਵੇਂ ਮੀਡੀਆ ਹਾਊਸਿਸ ਸਪੋਰਟ ਕਰਦੇ ਆ ਜਾਂ ਫਿਰ ਮੀਡੀਆ ਹਾਊਸਿਸ ਨੂੰ ਔਨ ਵੀ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਨੈਟਵਰਕਸ ਤੋਂ ਅਤੇ ਸਰਕਾਰਾਂ ਤੋਂ ਅਤੇ ਹੁਣ ਇਹ ਚੀਜ਼ ਦੇਖਣ ਨੂੰ ਮਿਲੀ ਹੈ ਵੀ ਸ਼ੋਸ਼ਲ ਮੀਡੀਆ ਇੱਕ ਨਵਾਂ ਜ਼ਰੀਆ ਉੱਭਰ ਕੇ ਆਇਆ ਜਿਹਦੇ 'ਤੇ ਖ਼ਬਰਾਂ ਨੂੰ ਬਿਨਾਂ ਕਿਸੀ ਛੇੜਛਾੜ ਤੋਂ ਸਿੱਧਾਂ ਸੱਚ ਪ੍ਰਸਤੂਤ ਕੀਤਾ ਜਾਏ ਪਰ ਉਹਦੇ ਵਿੱਚ ਵੀ ਮੈਨੀਪੁਲੇਸ਼ਨ ਏ ਆਈ ਡੀ ਫੈਕਟਸ ਵਰਗੀਆ ਚੀਜ਼ਾਂ ਆ ਗਈਆਂ ਅਤੇ ਦਰਸ਼ਕਾਂ ਨੂੰ ਇਹ ਲੋੜ ਹੈ ਵੀ ਉਹ ਕਿਸੇ ਵੀ ਚੀਜ਼ ਨੂੰ ਪੜ੍ਹਨ ਸੋਚਣ ਸਮਝਣ ਫਿਰ ਹੀ ਯਕੀਨ ਕਰਨ